ਹਾਂ ਸਥਾਨਕ ਭਾਸ਼ਾ ਵਿੱਚ ਨਿਊਜ਼ ਚੈਨਲ ਹਨ ਜਿਵੇਂ ਪੀ ਟੀ ਸੀ ਪੰਜਾਬੀ ਡੀ ਡੀ ਪੰਜਾਬੀ ਟੀ ਸੀ ਨਿਊਜ਼ ਜ਼ੀ ਪੰਜਾਬੀ ਆਦਿ ਲੋਕ ਆਪਣੀ ਮੂਲ ਭਾਸ਼ਾ ਵਿੱਚ ਹੀ ਖਬਰਾਂ ਦੇਖਣਾ ਪਸੰਦ ਕਰਦੇ ਹਨ